ਪੰਜਾਬ ਵਿੱਚ ਵਿਅਕਤੀਆਂ ਜਾਂ ਕਾਰੋਬਾਰਾਂ ਵਿਚਕਾਰ ਝਗੜਿਆਂ ਜਾਂ ਟਕਰਾਵਾਂ ਨੂੰ ਹੱਲ ਕਰਨ ਲਈ ਬਹੁਤ ਸਾਰੀਆਂ ਕਾਨੂੰਨੀ ਵਿਵਸਥਾਵਾਂ ਜਾਂ ਪ੍ਰਕਿਰਿਆਵਾਂ ਬਣੀਆਂ ਹੁੰਦੀਆਂ ਹਨ ਜਿਵੇਂ ਕਿ ਕਈ ਕਾਰਨਾਂ ਕਰਕੇ ਜਿਵੇਂ ਅ ਕਿਸੇ ਨਾਲ ਸਾਂਝਾ ਬਿਜ਼ਨਸ ਆਪਣਾ ਚੱਲ ਰਿਹਾ ਹੈ ਉਸ ਦੇ ਵਿੱਚ ਕੋਈ ਅਣਬਣ ਹੋ ਜਾਂਦੀ ਹੈ ਤਾਂ ਉਸ ਤਰੀਕੇ ਨੂੰ ਅਸੀਂ ਕਿਵੇਂ ਹੱਲ ਕਰਨਾ ਹੈ ਉਹ ਮੁਕੱਦਮਾ ਅਸੀਂ ਇੱਕ ਦੂਜੇ ਨਾਲ ਕੋਈ ਸਮਝੌਤਾ ਵੀ ਕਰ ਸਕਦੇ ਹਾਂ ਜਾਂ ਕੋਈ ਵੀ ਉਤਰਾਅ ਚੜਾਅ ਹੁੰਦਾ ਹੈ ਤਾਂ ਉਹ ਕਿਵੇਂ ਹੱਲ ਹੁੰਦਾ ਹੈ ਉਸ ਲਈ ਕਾਨੂੰਨੀ ਅਲੱਗ ਅਲੱਗ ਕਾਨੂੰਨ ਬਣੇ ਹੋਏ ਹਨ ਜਾਂ ਅਸੀਂ ਇੱਕ ਜਿਵੇਂ ਇੱਕ ਬੰਦਾ ਜਿਸ ਦੇ ਨਾਲ ਧੋਖਾ ਹੋਇਆ ਹੈ ਅਤੇ ਜਿਸ ਵੱਲੋਂ ਧੋਖਾ ਕੀਤਾ ਗਿਆ ਹੈ ਉਸ 'ਤੇ ਮੁਕਦਮੇਬਾਜ਼ੀ ਚਲਾ ਸਕਦਾ ਹੈ ਆਪਣੇ ਵੱਲੋਂ ਵਕੀਲ ਕਰ ਸਕਦਾ ਹੈ ਅਤੇ ਉਹ ਕੇਸ ਕੋਰਟ ਵਿੱਚ ਲੜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਫੈਸਲੇ ਦੀ ਉਡੀਕ ਕੀਤੀ ਜਾਂਦੀ ਹੈ ਜਾਂ ਕਈ ਇਹੋ ਜਿਹੀਆਂ ਤਕਨੀਕਾਂ ਬਣੀਆਂ ਹੋਈਆਂ ਹਨ ਜਿਹਨਾਂ ਵਿੱਚ ਆਪਾਂ ਕੋਈ ਅਪ ਵਿਚਕਾਰ ਵਿਚੋਲਾ ਪਾ ਕੇ ਉਸਦੇ ਨਾਲ ਗੱਲ ਕਰਕੇ ਉਹ ਆਪਣੀ ਗੱਲ ਉਸ ਬੰਦੇ ਤੱਕ ਪਹੁੰਚਾ ਸਕਦਾ ਹੈ ਜਿਸ ਨਾਲ ਆਪਣਾ ਝਗੜਾ ਹੋਇਆ ਹੈ ਇਸ ਤਰੀਕੇ ਨਾਲ ਇਹ ਬਹੁਤ ਸਾਰੀਆਂ ਕਾਨੂੰਨੀ ਵਿਵਸਥਾਵਾਂ ਹਨ ਜੋ ਸਾਨੂੰ ਆਪਣਾ ਆਪਣੀ ਮੁਸ਼ਕਿਲ ਨੂੰ ਹੱਲ ਕਰਨ ਵਿੱਚ ਮਦਦ ਕਰਦੀਆਂ ਹਨ